ਸਤਿ ਸ਼੍ਰੀ ਅਕਾਲ ਤੁਸੀਂ ਕੌਣ ਹਾਂਜੀ ਅਸੀਂ ਵਧੀਆ ਤੁਸੀਂ ਆਪਣਾ ਸੁਣਾਓ ਕਿੱਦਾਂ ਹਾਂਜੀ ਹਾਂਜੀ ਮੈਂ ਹਰਪ੍ਰੀਤ ਕੌਰ

ਹੋਰ ਬਸ ਵਧੀਆ ਤੁਸੀਂ ਆਪਣਾ ਸੁਣਾਓ ਕਿੱਦਾਂ ਸਕੂਲ ਸਾਡਾ ਬਹੁਤ ਵਧੀਆ ਚੱਲਦਾ ਆ ਜਿਵੇਂ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਕਿੰਨੀਆਂ ਪ੍ਰੋਬਲਮਸ ਆ ਚੁੱਕੀਆਂ ਹੈ ਨਾ ਬੱਚੇ ਐਸ ਆ ਟੀਚਰ ਤਾਂ ਬਹੁਤ ਜ਼ਿਆਦਾ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਅੱਜ ਕੱਲ੍ਹ ਹਾਂ ਇਸ ਟਾਈਮ ਤਾਂ ਬਹੁਤ ਔਖਾ ਹੋ ਚੁੱਕਾ ਕਿਉਂਕਿ ਜਿਹੜਾ ਕੋਪੀਟੀਸ਼ਨ ਹੈ ਸਕੂਲਾਂ ਦੇ ਵਿੱਚ ਉਹ ਵੀ ਬਹੁਤ ਵੱਧ ਚੁੱਕਾ ਹੁਣ ਜਿਸ ਕਰਕੇ ਸਕੂਲ ਵੱਲੋਂ ਪੇਰੈਂਟਸ ਵੱਲੋਂ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ ਅੱਜ ਕੱਲ੍ਹ ਕਿਉਂਕਿ ਹਾਂਜੀ ਹਾਂਜੀ ਇਹ ਤਾਂ ਹੈ ਹੀ ਕਿਉਂਕਿ ਮੈਨੇਜਮੈਂਟ ਨੂੰ ਇਹ ਆ ਕਿ ਜਿਸ ਏਰੀਏ 'ਚ ਸਾਡਾ ਸਕੂਲ ਖੁੱਲ੍ਹਿਆ ਆ ਉਸ ਏਰੀਏ ਦੇ ਵਿੱਚ ਸਾਡੀ ਹੀ ਹੀ ਬੱਲੇ ਬੱਲੇ ਹੋਵੇ ਸਾਰੇ ਪੇਰੈਂਟਸ ਆ ਮਾਪਿਆਂ ਦਾ ਝੁਕਾਅ ਵੀ ਸਾਡੇ ਸਕੂਲ ਵੱਲ ਹੋਵੇ ਪਰ ਉਹਦਾ ਇੱਕ ਇਹ ਵੀ ਹੈਗਾ ਕਿ ਜਿੱਦਾਂ ਸਕੂਲ ਹੁਣ ਬਹੁਤ ਸਾਰੇ ਖੁੱਲ੍ਹ ਚੁੱਕੇ ਆ ਅਤੇ ਕੋਪੀਟੀਸ਼ਨ ਵੀ ਬਹੁਤ ਵੱਧ ਚੁੱਕਾ ਆ ਤਾਂ ਹੁਣ ਆਪਾਂ ਆਮ ਦੇਖਦੇ ਹਾਂ ਦੇਖਦੇ ਹਾਂ ਕਿ ਪੇਰੈਂਟਸ ਦੇ ਇੱਕ ਇੱਕ ਦੋ ਦੋ ਬੱਚੇ ਹੀ ਆ ਹੈ ਨਾ ਬਹੁਤ ਫੀਫਟੀ ਪਰਸੈਂਟ ਪੰਜਾਬ ਦੀ ਜਨਰੇਸ਼ਨ ਹੈ ਜਿਹੜੀ ਉਹ ਤਾਂ ਜਨਸੰਖਿਆ ਬਰੇਨ ਡ੍ਰੇਨ ਕਰਕੇ ਫੋਰਨ ਵਿੱਚ ਹੀ ਸੈੱਟ ਹੋ ਚੁੱਕੀ ਆ ਅਤੇ ਜਿਸ ਕਰਕੇ ਜਿਹੜੇ ਅਧਿਆਪਕ ਇੱਥੇ ਬਣ ਚੁੱਕੇ ਆ ਸਕੂਲਾਂ 'ਚ ਪੜ੍ਹਾ ਰਹੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਇੱਕ ਉਹਨਾਂ ਨੂੰ ਜਿਹੜਾ ਨਾ ਮਾਇੰਡ ਨੂੰ ਅਪਸੈਟ ਕੀਤਾ ਜਾ ਰਿਹਾ ਆ ਕਿ ਤੁਸੀਂ ਜੇ ਪੜ੍ਹਾਉਣਾ ਆ ਤਾਂ ਇਸ ਤਰ੍ਹਾਂ ਹੀ ਪੜ੍ਹਾਉਣਾ ਆ ਜੇ ਇਸ ਸਕੂਲ 'ਚ ਜ ਜਿਹੜਾ ਡਿਸਿਪਲਨ ਨੇ ਆ ਜਾਂ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਉਹ ਸਿਰਫ ਇੱਕ ਟੀਚਰ ਲਈ ਹੀ ਅਪਲਾਈ ਕੀਤੇ ਜਾਂਦੇ ਆ ਮੈਨੇਜਮੈਂਟ ਵੱਲੋਂ ਬੱਚਿਆਂ ਨੂੰ ਤਾਂ ਉਹ ਕੁਛ ਕਹਿਣਾ ਹੀ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਨੂੰ ਇਹ ਹੈ ਕਿ ਬੱਚਿਆਂ ਦੇ ਕੋਲੋਂ ਹੀ ਤਾਂ ਉਹਨਾਂ ਨੂੰ ਇਨਕਮ ਸਪੋਰਟ ਆ ਇਸ ਕਰਕੇ ਹੀ ਡਿਸਿਪਲਨ ਦੀ ਅਤੇ ਇਹੀ ਕਾਰਨ ਹੈ ਨਾ ਉਹਦਾ ਆਪਣੇ ਆਪ ਡਿਸੀਜ਼ਨ ਲੈ ਸਕਣ ਇਹਦਾ ਵੀ ਇੱਕ ਸਭ ਤੋਂ ਵੱਡਾ ਕਾਰਨ ਮੈਮ ਉਹਦਾ ਇਹ ਆ ਵੀ ਸੋਸ਼ਲ ਮੀਡੀਆ ਅਸਲ ਵਿੱਚ ਕੋਈ ਵੀ ਛੋਟੀ ਮੋਟੀ ਵੀ ਗੱਲ ਕਿਸੇ ਵੀ ਸਕੂਲ ਦੇ ਵਿੱਚ ਘਟਨਾ ਕੋਈ ਵਾਪਰ ਜਾਂਦੀ ਹੈ ਨਾ ਤਾਂ ਉਹਨੂੰ ਜਿਹੜਾ ਅੱਜ ਦਾ ਮੀਡੀਆ ਆ ਆਧੁਨਿਕ ਮੀਡੀਆ ਉਹ ਇੰਨਾ ਕੁ ਗਲਤ ਰਾਇਤਾ ਫੈਲਾ ਦਿੰਦਾ ਉਹਦਾ ਕਿ ਜਦੋਂ ਉਹਨਾਂ 'ਚੋਂ ਇਹ ਲੱਗਦਾ ਕਿ ਸਕੂਲ ਦੀ ਅਤੇ ਅਧਿਆਪਕਾਂ ਦੀ ਹੀ ਗਲਤੀ ਆ ਬੱਚੇ ਦੀ ਤਾਂ ਕੋਈ ਗਲਤੀ ਹੀ ਨਹੀਂ ਹੈਗੀ ਪਰ ਜਦੋਂ ਉਹਨੂੰ ਅਸਲ ਵਿੱਚ ਮੀਡੀਆ ਹੀ ਚੰਗੀ ਤਰ੍ਹਾਂ ਦਿਖਾਵੇ ਤਾਂ ਐਕਚੁਲੀ ਦੇ ਵਿੱਚ ਜੋ ਅਸਲ ਵਿੱਚ ਪ੍ਰੋਬਲਮ ਆ ਜਾਂ ਜੋ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਐ ਜਦੋਂ ਉੱਥੇ ਤੱਕ ਪਹੁੰਚਿਆ ਜਾਵੇ ਅਤੇ ਫਿਰ ਆਪ ਹੀ ਅਧਿਆਪਕ ਦਾ ਵੀ ਸਤਿਕਾਰ ਹੋਵੇ ਜਦੋਂ ਹੁਣ ਛੋਟੇ ਜਿਹੇ ਬੱਚੇ ਨੂੰ ਮੰਨ ਲਓ ਅਸੀਂ ਬਰਬਲੀ ਹੀ ਡਾਂਟ ਦਿੰਦੇ ਬੱਚਾ ਮੰਨ ਲਓ ਘਰ ਜਾ ਕੇ ਕਹਿੰਦਾ ਕਿ ਟੀਚਰ ਨੇ ਮੈਨੂੰ ਬਹੁਤ ਡਾਂਟਿਆ ਮਾਰਿਆ ਉੱਥੇ ਕੋਈ ਪਰੂਫ ਤਾਂ ਹੋਣਾ ਨਹੀਂ ਕਿਸੇ ਦੇ ਕੋਲ ਵੀ ਪੇਰੈਂਟਸ ਨੇ ਦੋ ਚਾਰ ਹੋਰ ਵੀ ਆਂਢੀ ਗੁਆਂਢੀ ਇਕੱਠੇ ਕਰਕੇ ਲੈ ਆਉਣੇ ਨਾਲ ਮੀਡੀਆ ਲੈ ਆਉਣਾ ਫਿਰ ਉਹ ਮੀਡੀਆ ਜਿਹੜਾ ਆ ਉਹ ਸਿਰਫ ਤੋਂ ਸਿਰਫ ਮਾਪਿਆਂ ਦੀ ਹੀ ਸੁਣਦਾ ਆ ਉਹਨਾਂ ਦੀ ਹੀ ਰਿਕੋਰਡਿੰਗ ਕਰਕੇ ਇਸ ਲਾਇਆ ਜਾਂਦਾ ਜਦੋਂ ਇਹ ਟੀ ਵੀ ਚੈਨਲਾਂ 'ਤੇ ਹੋਰ ਸਾਰੇ ਜਿਹੜੇ ਚੈਨਲ ਆ ਖਬਰਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਜਦੋਂ ਕੋਈ ਘਟਨਾ ਛਾਪੀ ਜਾਂਦੀ ਆ ਅਤੇ ਨਾਈਨਟੀ ਨਾਈਨ ਪ੍ਰਤੀਸ਼ਤ ਜਿਹੜੀ ਗਲਤੀ ਆ ਉਹ ਅਧਿਆਪਕ ਦੀ ਹੀ ਕੱਢੀ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਮੈਨੇਜਮੈਂਟ ਵੀ ਪਿੱਛੇ ਹਟ ਜਾਂਦੀ ਆ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਆ ਕਿ ਅਸੀਂ ਜਿਹੜਾ ਅਧਿਆਪਕ ਆ ਉਹਦੇ ਹੀ ਸਪੁਰਦ ਕਰ ਦਿੱਤੇ ਸੀ ਬੱਚੇ ਉਹਨਾਂ ਨੇ ਹੀ ਅੱਗੇ ਟੇਕਿਆ ਕਰਨੀ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਜਿੱਦਾਂ ਜਿਹੜੇ ਰੂਲ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਆ ਨਾ ਉਹ ਸਿਰਫ ਸਾਡੇ ਲਈ ਆ ਟੀਚਰਾਂ ਲਈ ਜਦੋਂ ਬੱਚਿਆਂ ਦੇ ਨਾਲ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਇੰਨਾ ਕੁ ਅਵੇਅਰ ਕਰਤਾ ਕਿ ਜੇ ਬਈ ਤੁਹਾਨੂੰ ਟੀਚਰ ਡਾਂਟਦਾ ਆ ਅਤੇ ਤੁਸੀਂ ਆ ਕੇ ਦੱਸ ਦਿਓ ਅਤੇ ਅਸੀਂ ਆਪਣੇ ਆਪ ਕੋਈ ਨਾ ਕੋਈ ਉਹਦੀ ਸਾਡੀ ਮਤਲਬ ਅਧਿਆਪਕਾਂ ਦੀ ਟੰਗ ਖਿੱਚਾਂਗੇ ਸਮਾਂ ਵੀ ਇਹੀ ਮੰਗਦਾ ਆ ਅਤੇ ਇਸ ਕਰਕੇ ਐਜ਼ੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਿਰਫ ਤੋਂ ਸਿਰਫ ਪ੍ਰੋਬਲਮ ਆ ਜਿਹੜੀਆਂ ਸਮੱਸਿਆਵਾਂ ਨਾ ਉਹ ਇੱਕ ਅਧਿਆਪਕਾਂ ਲਈ ਹੀ ਖੜ੍ਹੀਆਂ ਹੋ ਰਹੀਆਂ ਬੱਚਾ ਵੀ ਸੁਰੱਖਿਅਤ ਹੈ ਮੈਨੇਜਮੈਂਟ ਵੀ ਸੁਰੱਖਿਅਤ ਹੈ ਕਿਉਂਕਿ ਮੈਨੇਜਮੈਂਟ ਹੀ ਇੱਦਾਂ ਦੇ ਰੂਲ ਬਣਾ ਰਹੀ ਆ ਕਿ ਉਹਨਾਂ ਨੂੰ ਲੱਗਦਾ ਆ ਕਿ ਅਧਿਆਪਕ ਹੀ ਕਰ ਸਕਦਾ ਜੋ ਕੁਛ ਕਰ ਸਕਦਾ ਆ ਬਿਲਕੁਲ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਹੰਡਰਡ ਪਰਸੈਂਟ ਹਾਂਜੀ ਸਹਿਮਤ ਹਾਂ ਠੀਕ ਹੈ ਓਕੇ ਓਕੇ ਠੀਕ ਹੈ ਮੈਮ ਓਕੇ ਸਤਿ ਸ਼੍ਰੀ ਅਕਾਲ ਠੀਕ ਹੈ ਮੈਮ ਸਤਿ ਸ਼੍ਰੀ ਅਕਾਲ ਓਕੇ ਓਕੇ